ਸਤਿ ਸ਼੍ਰੀ ਅਕਾਲ ਸਰ ਮੈਂ ਸੁਰਜੀਤ ਕੁਮਾਰ ਪਠਾਨਕੋਟ ਤੋਂ ਬੋਲਦਾ ਹਾਂ ਜਿੱਦਾਂ ਕਿ ਸਾਡਾ ਪੰਜਾਬ ਤਿਉਹਾਰਾਂ ਦੀ ਧਰਤੀ ਹੈ ਇਸ ਵਿੱਚ ਹਰ ਕਿਸਮ ਦੇ ਤਿਉਹਾਰ ਮਨਾਏ ਜਾਂਦੇ ਹਨ ਜਿੱਦਾਂ ਕਿ ਦੁਸ਼ਹਿਰਾ ਦੀਵਾਲੀ ਹੋਲੀ ਗੁਰਪੁਰਬ ਇੱਦਾਂ ਦੇ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਇੱਦਾਂ ਜਦੋਂ ਬਾਤ ਕਰੀਏ ਮੇਲਿਆਂ ਦੀ ਤਾਂ ਗਰਮੀਆਂ ਵਿੱਚ ਬੜੇ ਮੇਲੇ ਲੱਗਦੇ ਹਨ ਜਿੱਦਾਂ ਕਿ ਪਠਾਨਕੋਟ ਵਿੱਚ ਆਦਿ ਪਿੰਡਾਂ ਵਿੱਚ ਜਿੱਦਾਂ ਕਿ ਦੀਵਾਲੀ ਦਾ ਤਿਉਹਾਰ ਹੁੰਦਾ ਹੈ ਉਸ ਤਾਂ ਜਾਂ ਦੁਸ਼ਹਿਰੇ ਦਾ ਤਿਉਹਾਰ ਹੁੰਦਾ ਹੈ ਉਸ ਤੋਂ ਪਹਿਲਾਂ ਸਾਡੇ ਨੌ ਨਰਾਤੇ ਹੁੰਦੇ ਹਨ ਜਿਸ ਵਿੱਚ ਕਿ ਨੌ ਨਰਾਤਿਆਂ ਵਿੱਚ ਰਾਮਾਇਣ ਦਸਤਰਸ਼ਾਈ ਜਾਂਦੀ ਹੈ ਉਸ ਨੌ ਦਿਨ ਵਿੱਚ ਬੜਾ ਹੀ ਮਨੋਰੰਜਨ ਹੁੰਦਾ ਹੈ ਅਤੇ ਰਾਮ ਜੀ ਦੀ ਹੀ ਜੀਵਨ ਦੀ ਵਿਆਖਿਆ ਕਰਦੇ ਹਨ ਅਤੇ ਬਾਤ ਕਰੀਏ ਨਰਾਤਿਆਂ ਦੀ ਅਤੇ ਰਾਤ ਨੂੰ ਰਾਮ ਲੀਲ੍ਹਾ ਔਰ ਦਿਨ ਵੇਲੇ ਮਾਤਾ ਦੇ ਮੇਲੇ ਲੱਗਦੇ ਹਨ ਨੌ ਨਰਾਤਿਆਂ ਵਿੱਚ ਤਾਂ ਜਦੋਂ ਬਾਤ ਹੋ ਜਿੱਦਾਂ ਕਿ ਹੋ ਜਿੱਦਾਂ ਕਿ ਅੱਗੇ ਗੁਰਪੁਰਬ ਹੁੰਦਾ ਹੈ ਉਸ ਦਿਨ ਵੀ ਬੜੀ ਬੜੀ ਬੜਾ ਮੇਲਾ ਹੁੰਦਾ ਹੈ ਅਤੇ ਲੋਕ ਸਵੇਰੇ ਚਾਰ ਵਜੇ ਉੱਠ ਕੇ ਪੂਰੇ ਪਿੰਡੇ ਵਿੱਚ ਪ੍ਰਭਾਤ ਫੇਰੀ ਕਰਦੇ ਹਨ ਜੋ ਕਿ ਸਾਡਾ ਪੰਜਾਬ ਤਿਉਹਾਰਾਂ ਦੀ ਧਰਤੀ ਹੈ ਇਸ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ